ਜਿਵੇਂ ਗਾਇਨ ਵਿੱਚ ਅਸੀਂ ਆਪਣੇ ਸਾਹ ਨਿਯੰਤਰਣ ਨੂੰ ਕਿਵੇਂ ਰੱਖ ਸਕਦੇ ਹਾਂ ਅਸੀਂ ਜਦੋਂ ਅਸੀਂ ਗਾਉਣਾ ਹੈਗਾ ਅਸੀਂ ਆਪਣੇ ਸਾਹ ਨੂੰ ਨਿਯੰਤਰਣ ਰੱਖਣਾ ਬਹੁਤ ਜ਼ਰੂਰੀ ਹੈ ਸਾਨੂੰ ਅਤੇ ਇਸਨੂੰ ਆਪਾਂ ਨਿਯੰਤਰਣ ਕਿਵੇਂ ਰੱਖ ਸਕਦੇ ਹਾਂ ਜਿਵੇਂ ਆਪਾਂ ਵੀ ਜਿਵੇਂ ਜਿਵੇਂ ਰਿਆਜ਼ ਰਾਹੀਂ ਰਿਆਜ਼ ਕਰਨਾ ਬਹੁਤ ਜ਼ਰੂਰੀ ਹੈ ਰਿਆਜ਼ ਕਰਨ ਨਾਲ ਵੀ ਜਿਵੇਂ ਸਾਹ ਦਾ ਨਿਯੰਤਰਣ ਬਣਦਾ ਅਤੇ ਜਿਵੇਂ ਜਿਵੇਂ ਆਪਾਂ ਜਿਵੇਂ ਆਪਾਂ ਜਿਹੜੀ ਵੀ ਵਿੱਚ ਅਤੇ ਗਾਉਣਾ ਜਿਵੇਂ ਹਾਈ ਜਿਵੇਂ ਉੱਪਰ ਉਪਰਲੇ ਲੈਅ ਵਿੱਚ ਗਾਉਣਾ ਜਾਂ ਉਸ ਵਿੱਚ ਸਾਹ ਨੂੰ ਜ਼ਿਆਦਾ ਜਾਂ ਨੀਵੀ ਲੈਅ ਵਿੱਚ ਗਾਉਣਾ ਹੈਗਾ ਜਿਵੇਂ ਅਤੇ ਫਿਰ ਅਸੀਂ ਸਾਹ ਨੂੰ ਉਵੇਂ ਉਵੇਂ ਹੀ ਰੱਖਾਂਗੇ ਮਤਲਬ ਇਸ ਲਈ ਸਾਹ ਜਿਵੇਂ ਅਸੀਂ ਸਾਹ ਦਾ ਨਿਯੰਤਰਣ ਆਪਣੇ ਉੱਤੇ ਰੱਖਣਾ ਇਸ ਲਈ ਜ਼ਰੂਰੀ ਹੈ ਜਿਵੇਂ ਸਾਹ ਦੇ ਨਿਯੰਤਰਨ ਨੂੰ ਤਾਂ ਅਸੀਂ ਗਾਉਣ ਵਿੱਚ ਆਰਾਮਦਾਇਕ ਮਤਲਬ ਮਹਿਸੂਸ ਕਰਨਗੇ ਜੇ ਆਪਣਾ ਸਾਹ ਨਿਯੰਤਰਣ ਨਹੀਂ ਹੋਵੇਗਾ ਤਾਂ ਫਿਰ ਸਾਨੂੰ ਗਾਉਣ ਵਿੱਚ ਮੁਸ਼ਕਿਲ ਆਵੇਗੀ ਜਿਵੇਂ ਅਸੀਂ ਜਿਵੇਂ ਅਸੀਂ ਜਲਦੀ ਥੱਕ ਜਾਣਾ ਗਾਉਣ ਵਿੱਚ ਸਾਡ ਸਾਹ ਚੜ੍ਹੇਗਾ ਇਸ ਲਈ ਇਸ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ ਜਿਵੇਂ ਅਸੀਂ ਫੇਫੜਿਆ ਰਾਹੀਂ ਸਾਹ ਲੈਣ ਦਾ ਅਭਿਆਸ ਕਰ ਸਕਦੇ ਹਾਂ ਅਤੇ ਇਸ ਨੂੰ ਡੂੰਘੇ ਸਾਹ ਜਿਵੇਂ ਤੁਹਾਨੂੰ ਡੂੰਘੇ ਸਾਹ ਲੈਣ ਦੀ ਤੁਹਾਡੀ ਮਦਦ ਕਰ ਸਕਦੇ ਹਾਂ ਜਿਵੇਂ ਸਾਹ ਅਭਿਆਸ ਕਰ ਸਕਦੇ ਹਾਂ ਆਪਾਂ ਆਪਣੇ ਸਾਹ ਲੈਣ ਨਿਯੰਤਰਣ ਵਿਕਸਿਤ ਕਰਨ ਲਈ ਹੇਜ ਹੇਜਇੰਗ ਜਾਂ ਵਰਗੇ ਅਭਿਆਸ ਕਰ ਸਕਦੇ ਹਾਂ ਸਹੀ ਅਸਲ ਵਿੱਚ ਗਾਉਣਾ ਵੀ ਮਦਦ ਕਰ ਸਕਦੇ ਹਾਂ ਇਹਦੇ ਵਿੱਚ ਜਿਵੇਂ ਤੁਹਾਡੇ ਫੇਫੜਿਆ ਨੂੰ ਪੂਰੀ ਤਰ੍ਹਾਂ ਫੈਲਣ ਦੇਣ ਲਈ ਦੇਣ ਲਈ ਸਹੀ ਖੜ੍ਹੇ ਹੋ ਜਾਓ ਉੱਚੇ ਬੈਠੋ ਅਤੇ ਪੇਸ਼ੇਵਾਰ ਮਾਰਗ ਦਰਸ਼ਨ ਦੀ ਲੋੜ ਮਤਲਬ ਇਹਦੇ ਵਿੱਚ ਇੱਕ ਕੋਚ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਜਿਹੜਾ ਤੁਹਾਡੇ ਗਾਉਣ ਵਿੱਚ ਸਾਹ ਨਿਯੰਤਰਣ ਰੱਖਣ ਵਿੱਚ ਜ਼ਿਆਦਾਤਰ ਮਦਦ ਕਰਦਾ ਇਸਦੀ ਸਾਡੇ ਗਾਉਣ ਸਬੰਧੀ ਗਾਉਣ ਲਈ ਇੱਕ ਕੋਚ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ